ਹਾਂਜੀ ਮੈਮ ਹਾਂਜੀ ਮੈਮ ਹਾਂਜੀ ਮੈਮ ਦਸ ਹਾਂਜੀ ਮੈਮ ਕੀ ਪੇਸ਼ੰਟ ਦੀ ਤੁਸੀਂ ਮੈਨੂੰ ਥੋੜ੍ਹੀ ਡਿਟੇਲ ਦੇ ਦਿਓ ਪੇਸ਼ੰਟ ਪੇਸ਼ੰਟ ਨੂੰ ਹੈ ਹਾਂਜੀ ਪੇਸ਼ੰਟ ਦਾ ਨੇਮ ਬੋਲਿਓ ਹਾਂਜੀ ਉਹਨਾਂ ਦੀ ਏਜ ਰਪੀਟ ਕਰਿਓ ਮੈਮ ਓਕੇ ਮੈਮ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ

ਹਾਂਜੀ ਮੈਮ ਅੱਛਾ ਓਕੇ ਮੈਮ ਤੁਸੀਂ ਪੇਸ਼ੰਟ ਦਾ ਮੈਨੂੰ ਥੋੜ੍ਹਾ ਦੱਸ ਦਿਓ ਕਿ ਪੇਸ਼ੰਟ ਬੈਡ ਰੀਟਨ ਆ ਜਾਂ ਥੋੜ੍ਹਾ ਚੱਲ ਫਿਰ ਲੈਂਦੇ ਆ ਓਕੇ ਜੀ ਹਾਂਜੀ

ਓਕੇ ਮੈਮ ਮੈਮ ਟਵੰਟੀ ਫੋਰ ਆਰਸ ਲਈ ਤੁਹਾਨੂੰ ਨਰਸਿਸ ਚਾਹੀਦੀ ਆ ਜਾਂ ਫਿਰ ਤੁਹਾਨੂੰ ਟੂ ਟਾਈਮ ਜਿਹੜੀ ਨਰਸ ਆ ਕੇ ਕੇਅਰ ਪ੍ਰੋਵਾਈਡ ਕਰ ਸਕੇ ਹੋ ਨਰਸ ਚਾਹੀਦੀ ਹੈ ਹਾਂਜੀ ਉਹ ਮੈਮ ਤੁਹਾਨੂੰ ਮੈਂ ਪੈਕੇਜ ਪੈਕੇਜ ਦੀ ਡਿਟੇਲ ਬਾਅਦ ਵਿੱਚ ਸਾਰਾ ਦੱਸ ਦਵਾਂਗੀ ਉਹ ਸਾਡਾ ਪੈਕੇਜ ਹੁੰਦਾ ਹੈ ਹਾਂਜੀ ਮੈਮ ਤੁਸੀਂ ਪੇਸ਼ੰਟ ਦੀ ਕੇਅਰ ਲਈ ਗਰਲਸ ਹਾਇਰ ਕਰਨਾ ਚਾਹੁੰਦੇ ਹੋ ਜਾਂ ਬੋਆਏ ਮੈਮ ਸਾਡੇ ਕੋਲ ਦੋਨਾਂ ਦੀ ਅਵਿਲਟੀ ਹੈ ਅਸੀਂ ਬੋਆਇਜ਼ ਵੀ ਹੋਸਪਿਟਲ ਕੇਅਰ ਕਰ ਸਕਦੇ ਹਾਂ ਹੋਮ ਕੇਅਰ ਲਈ ਐਂਡ ਗਰਲਸ ਵੀ ਇਹ ਤੁਹਾਡੀ ਓਕੇ ਮੈਮ ਓਕੇ ਮੈਮ ਮੈਮ ਸਾਡਾ ਮੈਕਸੀਮਮ ਦੇਖੋ ਟੂ ਟਾਈਮਸ ਟਵੰਟੀ ਫੋਰ ਆਰਸ ਪੇਸ਼ੰਟ ਨੂੰ ਕੇਅਰ ਪ੍ਰੋਵਾਈਡ ਐਕਸਪੀਰੀਅੰਸ ਸਟਾਫ ਹੁੰਦਾ ਹੈ ਅਤੇ ਤੁਹਾਨੂੰ ਕੋਈ ਕੰਪਲੇਂਟ ਨਹੀਂ ਮਿਲੇਗੀ ਫੁੱਲ ਗਰੰਟੀ ਹੁੰਦੀ ਹੈ ਸਾਡੀ ਅਗਰ ਕੋਈ ਅਮਰਜੰਸੀ ਪੈਂਦੀ ਹੈ ਸਾਡਾ ਇਜ਼ੀਲੀ ਹੈਂਡਲ ਕਰ ਲੈਂਦਾ ਕਿਉਂਕਿ ਸਾਡੇ ਸਟਾਫ ਓਲਮੋਸਟ ਵੈੱਲ ਐਕਸਪੀਰੀਅੰਸ ਨੇ ਉਹ ਐਮਰਜੰਸੀ ਨੂੰ ਡੀਲ ਕਰ ਸਕਦੇ ਹੈ ਜਿੱਦਾਂ ਤੁਹਾਡਾ ਪੇਸ਼ੰਟ ਆ ਔਰ ਤੁਸੀਂ ਦੱਸ ਰਹੇ ਮੈਡੀਸਨ ਵਗੈਰਾ ਲੈ ਰਿਹਾ ਤੁਹਾਨੂੰ ਉਹਦੀ ਕੋਈ ਫਿਕਰ ਨਹੀਂ ਆ ਉਹ ਸਾਡਾ ਜਿਹੜਾ ਸਟਾਫ ਹੋਏਗਾ ਉਹ ਖੁਦ ਹੀ ਵਿਜ਼ਿਟ ਕਰਵਾਏਗਾ ਡੋਕਟਰ ਕੋਲ ਲੈ ਕੇ ਜਾਏਗਾ ਸਾਡਾ ਅਰਾਉਂਡ ਥਰਟੀ ਥਾਊਸੰਡ ਮੈਕਸੀਮਮ ਪੈਕੇਜ ਹੈ ਮੰਥਲੀ ਓਕੇ ਮੈਮ ਮੈਮ ਤੁਸੀਂ ਜਦੋਂ ਕਹੋਗੇ ਸਟਾਫ ਆ ਜਾਏਗਾ ਥੈਂਕ ਯੂ ਮੈਮ ਓਕੇ ਥੈਂਕ ਯੂ ਮੈਮ